ਹਾਂਜੀ ਜਿਹੜੀਆਂ ਪੁਰਾਣੀਆਂ ਪੀੜੀਆਂ ਸੀ ਉਹ ਅੱਜ ਕੱਲ੍ਹ ਦੀਆਂ ਪੀੜੀਆਂ ਨਾਲੋਂ ਛੋਟੀਆਂ ਪੀੜੀਆਂ ਨਾਲੋਂ ਜ਼ਿਆਦਾ ਧਾਰਮਿਕ ਸਨ ਵਾ ਧਾਰਮਿਕ ਵਿਚਾਰਾਂ ਵਾਲੇ ਸਨ ਜਿਹੜੀਆਂ ਅੱਜ ਕੱਲ੍ਹ ਦੀ ਇਹਨਾਂ ਪੀੜ੍ਹੀਆਂ ਉਹ ਵਿਖਾਵਾ ਜ਼ਿਆਦਾ ਹੋ ਗਿਆ ਹੈ ਜਿਵੇਂ ਅੰਮ੍ਰਿਤ ਛੱਕ ਲੈਣਾ ਨਾਲ ਕੇਸਾਂ ਦੀ ਬੇਅਦਬੀ ਵੀ ਕਈ ਕਰ ਕਰਦੇ ਐਨ ਹੋਰ ਜਿਵੇਂ ਅ ਨਿਤਨੇਮ ਨਹੀਂ ਕਰਨਾ ਇਹਨਾਂ ਹੋਰ ਸਭ ਕੁਛ ਕਈ ਕੁਛ ਖਾਣ ਪੀਣ ਦੀ ਕੋਈ ਮਨਾਹੀ ਨਹੀਂ ਕਈ ਕਹਿੰਦੇ ਇਸ ਤਰ੍ਹਾਂ ਕਿ ਮੀਟ ਸ਼ਰਾਬ ਜੋ ਵੀ ਆ ਖਾਂਦੇ ਪੀਂਦੇ ਆ ਪਈ ਚੀਜ਼ ਸਹੀ ਨਹੀਂ ਇੰਨਾ ਪੁਰਾਣੀਆਂ ਜਿਹੜੀਆਂ ਪੀੜ੍ਹੀਆਂ ਸੀ ਉਹ ਪੂਰੇ ਐਨ ਧਾਰਮਿਕ ਵਿਚਾਰਾਂ ਵਾਲੇ ਸਨ ਜੋ ਕਿ ਜਿਹਨਾਂ ਵਿੱਚ ਕਿ ਦਿਖਾਵਾ ਘੱਟ ਸੀ ਮੇਨ ਗੱਲ ਇਹੀ ਆ ਇਹੀ ਦੇਖੀ ਆ ਦੇਖੀ ਜਾਂਦੀ ਹੈ ਪਿਛਲੀਆਂ ਪੀੜ੍ਹੀਆਂ ਅਤੇ ਅੱਜ ਕੱਲ੍ਹ ਦੀਆਂ ਵਖਾਵਾ ਦਿਖਾਵਾ ਬਹੁਤ ਜ਼ਿਆਦਾ ਹੋ ਗਿਆ ਅੱਜ ਕੱਲ੍ਹ ਇੰਨਾ ਪਿੱਛੇ ਜਿਹੇ ਵੀ ਪੰਜ ਕਕਾਰ ਸੀ ਅੰਮ੍ਰਿਤ ਛੱਕਣਾ ਨਾ ਪੰਜ ਕਕਾਰ ਅਲੱਗ ਨਹੀਂ ਸੀ ਕਰਦੇ ਹੁੰਦੇ ਸਰੀਰ ਨਾਲੋਂ ਪਰ ਅੱਜ ਕੱਲ੍ਹ ਜ਼ਿਆਦਾ ਦਿਖਾਵਾ ਹੋ ਗਿਆ ਸ਼ੋਸ਼ਲ ਮੀਡੀਆ 'ਤੇ ਵੀ ਦੇਖ ਲਈਦਾ ਸਿਰ 'ਤੇ ਕੇਸ ਦਸਤਾਰਾਂ ਬੰਨੀਆਂ ਵਾ ਅਤੇ ਕੇਸ ਕਟਵਾਏ ਕਤਲ ਕੀਤੇ ਇਹਨਾਂ ਜੋ ਕਿ ਸਹੀ ਗੱਲ ਵੀ ਨਹੀਂ ਹੈ ਫੇ ਇਸ ਤਰ੍ਹਾਂ ਇਸ ਤਰ੍ਹਾਂ ਬਹੁਤ ਜ਼ਿਆਦਾ ਜਿਹੜੀ ਤਬਦੀਲੀ ਦੇਖਣ ਨੂੰ ਮਿਲੀ ਗੀ ਜਿਹੜੇ ਸਾਡੇ ਵੱਡੇ ਵਡੇਰੇ ਸੀ ਉਹ ਧਾਰਮਿਕ ਵਿਚਾਰਾਂ ਵਾਲੇ ਸੀ ਜਿਹੜੀ ਗੱਲ ਕਰਦੇ ਸੀ ਉਹਨੂੰ ਪੂਰਾ ਉਹ ਓਸੇ ਤੇ ਉਸੇ 'ਤੇ ਹੀ ਰਹਿੰਦੇ ਸੀ ਇਨਾ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਸੀ ਅੱਜ ਕੱਲ੍ਹ ਬੇਅਦਬੀਆਂ ਬਹੁਤ ਜ਼ਿਆਦਾ ਵੱਧ ਗਈਆਂ ਇਨ ਲੋਕ ਲੋਕਾਂ 'ਚ ਡਰ ਸਹਿਮ ਘੱਟ ਗਿਆ ਇੰਨਾਂ ਗੁਰੂ ਪ੍ਰਤੀ ਵੀ ਇੰਨਾਂ ਰੱਬ ਪ੍ਰਤੀ ਵੀ ਇੰਨਾਂ